ਸਤਿ ਸ਼੍ਰੀ ਅਕਾਲ ਸਰ ਐਮਾਜ਼ੋਨ ਤੋਂ ਗੱਲ ਕਰਦੇ ਹੋ ਸਰ ਐਚੁਅਲੀ ਨਾ ਮੈਂ ਤੁਹਾਡੇ ਨਾ ਡਰਿੱਲ ਮੰਗਵਾਈ ਸੀ ਅਤੇ ਸਰ ਉਹ ਨਾ ਡਰਿੱਲ ਸਰ ਸਹੀ ਨਹੀਂ ਹੈ ਖ਼ਰਾਬ ਨਿਕਲੀ ਸਰ ਅਤੇ ਉਹਦਾ ਕਰਕੇ ਸਰ ਘਰ ਨਾ ਮੈਂ ਮਤਲਬ ਇਹਨਾਂ ਦੇ ਚੁਗਾਠਾਂ ਦੀ ਪੇਚ ਲਾਉਣੇ ਸੀ ਸਰ ਅਤੇ ਪ੍ਰੋਗਰਾਮ ਵੀ ਸੀ ਸਰ ਆਪਣੇ ਅਤੇ ਉਹਦਾ ਕਰਕੇ ਸਰ ਬਹੁਤ ਮੇਰੇ ਰਿਸ਼ਤੇਦਾਰ ਵੀ ਲੜਦੇ ਸੀ ਵੀ ਉਹ ਮਸ਼ੀਨ ਖ਼ਰਾਬ ਆ ਸਾਰਾ ਸਮਾਨ ਸਾਰਾ ਉਦੀ ਪਿਆ ਸੀਗਾ ਤੇ ਸਰ ਕਿਰਪਾ ਕਰਕੇ ਨਾ ਮੁਝੇ ਉਹਦਾ ਫੰਡ ਦਿੱਤਾ ਜਾਵੇ ਸਰ ਮੈਂ ਲੇਟ ਹੋ ਗਿਆ ਸਰ ਜੀ